ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਮੈਂ ਆਪਣੇ ਕੱਪੜੇ ਧੋਣ ਲਈ ਆਪਣੇ ਵਰਤੇ ਹੋਏ ਤਰੀਕੇ ਅਤੇ ਉਹਨਾਂ ਨੂੰ ਸਕਾਉਣ ਦੇ ਤਰੀਕਿਆਂ ਨੂੰ ਦੱਸਣਾ ਚਾਹੁੰਦਾ ਹਾਂ ਮੈਂ ਦੋ ਤਰੀਕਿਆਂ ਨਾਲ ਕੱਪੜੇ ਧੋਂਦਾ ਹਾਂ ਹੱਥਾਂ ਨਾਲ ਅਤੇ ਮਸ਼ੀਨ ਨਾਲ ਮੈਂ ਜ਼ਿਆਦਾਤਰ ਹੱਥਾਂ ਨਾਲ ਕੱਪੜੇ ਧੋਣੇ ਪਸੰਦ ਕਰਦਾ ਹਾਂ ਕਿਉਂਕਿ ਮੈਂ ਆਪਣੇ ਹੱਥਾਂ ਨਾਲ ਸਾਰੀ ਮੈਲ ਅਤੇ ਦਾਗਾਂ ਨੂੰ ਸਾਫ਼ ਕਰ ਸਕਦਾ ਹਾਂ ਅਤੇ ਮੈਨੂੰ ਇਹ ਕੰਮ ਤਸੱਲੀ ਬਖਸ਼ ਲੱਗਦਾ ਹੈ ਮੈਂ ਹੱਥਾਂ ਨਾਲ ਕੱਪੜੇ ਉਦੋਂ ਹੀ ਧੋਂਦਾ ਹਾਂ ਜਦੋਂ ਮੈਂ ਕੰਮ ਤੋਂ ਫ੍ਰੀ ਹੁੰਦਾ ਹਾਂ ਅਤੇ ਮੈਨੂੰ ਜ਼ਿਆਦਾ ਸਟ੍ਰੈੱਸ ਨਹੀਂ ਹੁੰਦਾ ਪਰ ਜਦੋਂ ਮੈਂ ਕੰਮ ਕਰਕੇ ਬਿਜ਼ੀ ਹੁੰਦਾ ਹਾਂ ਅਤੇ ਮੈਨੂੰ ਥੋੜ੍ਹਾ ਵੀ ਟਾਈਮ ਨਹੀਂ ਹੁੰਦਾ ਤਾਂ ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋਣਾ ਪ੍ਰੈਫਰ ਕਰਦਾ ਹਾਂ ਮੈਂ ਵਾਸ਼ਿੰਗ ਮਸ਼ੀਨ ਵਿੱਚ ਵਧੀਆ ਕੁਆਲਿਟੀ ਦਾ ਸਰਫ਼ ਵਰਤੋਂ ਕਰਕੇ ਆਪਣੇ ਕੱਪੜੇ ਧੋਣਾ ਪਸੰਦ ਕਰਦਾ ਹਾਂ ਤਾਂ ਜੋ ਸਾਰੇ ਦਾਗ ਸਾਫ਼ ਹੋਣ ਅਤੇ ਮੈਨੂੰ ਸਾਫ਼ ਸੁਥਰੇ ਕੱਪੜੇ ਮਿਲਣ ਮੈਂ ਗਰਮੀਆਂ ਵਿੱਚ ਆਪਣੇ ਕੱਪੜੇ ਧੁੱਪ ਵਿੱਚ ਸੁਕਾਉਣਾ ਪਸੰਦ ਕਰਦਾ ਹਾਂ ਪਰ ਮੀਂਹ ਅਤੇ ਠੰਡ ਵਿੱਚ ਧੁੱਪ ਨਾ ਨਿਕਲਣ ਕਰਕੇ ਮੈਂ ਆਪਣੇ ਕੱਪੜਿਆਂ ਨੂੰ ਡਰਾਇਰ ਜਾਂ ਮਸ਼ੀਨ ਨਾਲ ਸੁਕਾਉਂਦਾ ਹਾਂ ਪਰ ਜੇ ਮੈਨੂੰ ਫਿਰ ਵੀ ਕੱਪੜਿਆਂ ਵਿੱਚ ਨਮੀ ਲੱਗੇ ਮੈਨੂੰ ਕੱਪੜੇ ਗਿੱਲੇ ਲੱਗਣ ਤਾਂ ਮੈਂ ਕੱਪੜਿਆਂ ਉੱਤੇ ਪ੍ਰੈੱਸ ਮਾਰ ਕੇ ਇਹਨਾਂ ਨੂੰ ਸੁਕਾ ਕੇ ਆਪਣੀ ਯਕੀਨੀ ਬਣਾਉਂਦਾ ਹਾਂ ਧੰਨਵਾਦ